ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਕੁਛ ਉਹਨਾਂ ਬਿਮਾਰੀਆਂ ਦਾ ਜ਼ਿਕਰ ਕਰ ਰਹੀ ਹਾਂ ਜਿਹੜੀਆਂ ਕਿ ਮੌਸਮ ਦੇ ਬਦਲਣ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਦੇਖਿਆ ਜਾਏਗਾ ਤਾਂ ਜਿਵੇਂ ਬਰਸਾਤ ਦੇ ਮੌਸਮ ਵਿੱਚ ਆਮ ਤੌਰ 'ਤੇ ਹੈਜ਼ਾ ਹੋ ਜਾਂਦਾ ਹੈ ਹੈਜ਼ਾ ਸੋਚਿਆ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਵਾਧਾ ਘਾਟਾ ਖਾਣ ਦੇ ਨਾਲ ਹੁੰਦਾ ਹੈ ਬਰਸਾਤ ਦੇ ਮੌਸਮ ਵਿੱਚ ਸਾਡੀ ਪਾਚਨ ਪ੍ਰਣਾਲੀ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਸਰਦੀਆਂ ਵਿੱਚ ਜ਼ੁਕਾਮ ਅਤੇ ਫਲੂ ਹੋ ਜਾਂਦਾ ਹੈ ਗਰਮੀਆਂ ਵਿੱਚ ਮੱਛਰ ਦੇ ਕੱਟਣ ਨਾਲ ਮਲੇਰੀਆ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਇਹਨਾਂ ਬਿਮਾਰੀਆਂ ਦੇ ਮੌਸਮ ਦੇ ਬਦਲਣ ਨਾਲ ਤਾਪਮਾਨ ਦਾ ਬਦਲਾਓ ਹਵਾ ਵਿੱਚ ਬਦਲਾਓ ਕਾਰਨ ਇਹ ਬਿਮਾਰੀਆਂ ਹੁੰਦੀਆਂ ਹਨ ਇਹ ਬਿਮਾਰੀਆਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਜ਼ੁਕਾਮ ਛਿੱਕਾਂ ਖੰਘ ਗਲੇ ਵਿੱਚ ਖਰਾਸ਼ ਅੱਖਾਂ ਵਿੱਚ ਪਾਣੀ ਵਗਣਾ ਬੁਖਾਰ ਆਦਿ ਹੋਣਾ ਹੁੰਦਾ ਹੈ ਅਜਿਹੇ ਸਮੇਂ ਨਾ ਤਾਂ ਕੋਈ ਸੌਂ ਪਾਉਂਦਾ ਹੈ ਚੰਗੀ ਤਰ੍ਹਾਂ ਨਾ ਹੀ ਬੈਠ ਸਕਦਾ ਹੈ ਬੱਚਿਆਂ ਨੂੰ ਇਹ ਕੁਝ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਪਰ ਉਹਨਾਂ ਬੱਚਿਆਂ ਨੂੰ ਇਹ ਕੁਛ ਪ੍ਰਭਾਵ ਘੱਟ ਪਾਉਂਦੀਆਂ ਹਨ ਜਿਹਨਾਂ ਬੱਚਿਆਂ ਦਾ ਟੀਕਾਕਰਨ ਹੋ ਚੁੱਕਾ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਇਹੀ ਹੈ ਕਿ ਬੱਚਿਆਂ ਦਾ ਟੀਕਾਕਰਨ ਸਮੇਂ ਸਮੇਂ 'ਤੇ ਕਰਵਾਇਆ ਜਾਵੇ ਸਰਕਾਰੀ ਹਸਪਤਾਲਾਂ ਵਿੱਚ ਟੀਕਾਕਰਨ ਦੀ ਸੁਵਿਧਾ ਹਰ ਤਰ੍ਹਾਂ ਨਾਲ ਉਪਲਬਧ ਹੈ ਬੱਚੇ ਦੇ ਜਨਮ ਸਮੇਂ ਹੀ ਉਹਨਾਂ ਨੇ ਉਹ ਕਾਰਡ ਉਹ ਫਾਈਲ ਬਣਾ ਦਿੱਤੀ ਜਾਂਦੀ ਹੈ ਜਿਸ ਵਿੱਚ ਟੀਕਾਕਰਨ ਦਾ ਪੂਰਾ ਵੇਰਵਾ ਹੁੰਦਾ ਹੈ ਸਮੇਂ ਸਮੇਂ 'ਤੇ ਕਿਸ ਸਮੇਂ 'ਤੇ ਉਹ ਟੀਕਾ ਲਗਾਇਆ ਜਾਣਾ ਹੁੰਦਾ ਹੈ ਉਸ ਟੀਕੇ ਦੇ ਅਸਰ ਨਾਲ ਬੱਚੇ ਉਹਨਾਂ ਬਿਮਾਰੀਆਂ ਤੋਂ ਕੁਛ ਬਚ ਸਕਦੇ ਹਨ ਇਹ ਬਿਮਾਰੀਆਂ ਲੋਕਾਂ ਨੂੰ ਇੱਕ ਤੋਂ ਦੂਜੇ ਜਣਿਆਂ ਨੂੰ ਜਲਦੀ ਪ੍ਰਭਾਵਿਤ ਕਰਦੀਆਂ ਹਨ ਇਹਨਾਂ ਬਿਮਾਰੀਆਂ ਵਿੱਚ ਰੋਕਥਾਮ ਲਈ ਸਭ ਤੋਂ ਪਹਿਲੇ ਤੁਹਾਨੂੰ ਤਾਂ ਪਰਹੇਜ਼ ਇਹ ਚਾਹੀਦਾ ਹੈ ਕਿ ਜੇ ਕਿਸੇ ਵੱਡੇ ਨੂੰ ਅਜਿਹਾ ਕੋਈ ਰੋਗ ਹੈ ਤਾਂ ਉਹਨੂੰ ਛੋਟੇ ਬੱਚੇ ਨੂੰ ਜਲਦੀ ਪ੍ਰਭਾਵਿਤ ਕਰੇਗਾ ਇਸ ਲਈ ਆਪਣੇ ਮੂੰਹ 'ਤੇ ਮਾਸਕ ਜਾਂ ਮੂੰਹ ਢੱਕ ਕੇ ਰੱਖੋ ਖੰਘਣ ਸਮੇਂ ਖੰਘ ਮੂੰਹ ਨੂੰ ਢੱਕ ਕੇ ਖੰਘਣਾ ਚਾਹੀਦਾ ਹੈ ਛਿੱਕਾਂ ਮਾਰਦਿਆਂ ਹੋਇਆ ਇੱਕ ਸਾਈਡ 'ਤੇ ਮੂੰਹ 'ਤੇ ਹੱਥ ਰੱਖ ਕੇ ਛਿੱਕਾਂ ਮਾਰੋ ਤਾਂ ਜੋ ਦੂਜੇ ਕਿਸੇ ਨੂੰ ਪ੍ਰਭਾਵਿਤ ਨਾ ਕਰਨ ਧੰਨਵਾਦ ਜੀ